ਪਹਿਲੇ ਸਮੇਂ ਵਿੱਚ ਅਤੇ ਅੱਜ ਦੇ ਸਮੇਂ ਵਿੱਚ ਸਿਲਾਈ ਕਢਾਈ ਵਿੱਚ ਬਹੁਤ ਜ਼ਿਆਦਾ ਜ਼ਮੀਨ ਆਸਮਾਨ ਦਾ ਫ਼ਰਕ ਹੈ ਪਹਿਲਾਂ ਦੀ ਸਿਲਾਈ ਕਢਾਈ ਬਹੁਤ ਹੀ ਆਸਾਨ ਤਰੀਕੇ ਨਾਲ ਕੀਤੀ ਜਾਂਦੀ ਸੀ ਅਤੇ ਅੱਜ ਕੱਲ੍ਹ ਦੀ ਸਲਾਈ ਕਢਾਈ ਬੜੇ ਹੀ ਔਖੇ ਤਰੀਕੇ ਨਾਲ ਕੀਤੀ ਜਾਂਦੀ ਹੈ ਪਹਿਲਾਂ ਤਾਂ ਅਸੀਂ ਸਿੰਪਲ ਸਾਦੇ ਸਲਵਾਰ ਸੂਟ ਪੈਂਟ ਪਜਾਮੇ ਕੁੜਤੇ ਆਦਿ ਸਿਓਂਤੇ ਜਾਂਦੇ ਸੀ ਅਤੇ ਹੁਣ ਨਵੀਆਂ ਨਵੀਆਂ ਵਰਾਇਟੀਆਂ ਆ ਗਈਆਂ ਹਨ ਪੈਂਟ ਪਲਾਜੋ ਸਲਵਾਰਾਂ ਅਨਾਰਕਲੀ ਸੂਟ ਵਗੈਰਾ ਵਗੈਰਾ ਬਹੁਤ ਸਾਰੇ ਨਵੇਂ ਨਵੇਂ ਤਰੀਕੇ ਆ ਗਏ ਨਵੀਆਂ ਨਵੀਆਂ ਮਸ਼ੀਨਾਂ ਆ ਗਈਆਂ ਹਨ ਇਲੈਕਟ੍ਰਿਕ ਨਾਲ ਚੱਲਣ ਵਾਲੀਆਂ ਹੱਥਾਂ ਨਾਲ ਚੱਲਣ ਵਾਲੀਆਂ ਅਤੇ ਪੈਰਾਂ ਨਾਲ ਚੱਲਣ ਵਾਲੀਆਂ ਬਹੁਤ ਹੀ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਹਨ ਪਹਿਲਾਂ ਦੀ ਸਿਲਾਈ ਬਹੁਤ ਹੀ ਆਰਾਮ ਨਾਲ ਕੀਤੀ ਜਾਂਦੀ ਸੀ ਅਤੇ ਅੱਜ ਕੱਲ੍ਹ ਦੀ ਸਿਲਾਈ ਵਿੱਚ ਬੜਾ ਜ਼ਮੀਨ ਆਸਮਾਨ ਦਾ ਫ਼ਰਕ ਹੈ ਤਾਂ ਇਹ ਸਿਲਾਈ ਬਹੁਤ ਹੀ ਜ਼ਿਆਦਾ ਟਫ ਔਖੀ ਹੋ ਗਈ ਹੈ ਪਹਿਲੀ ਸਿਲਾਈ ਠੀਕ ਸੀ ਅੱਜ ਕੱਲ੍ਹ ਦੇ ਕੱਪੜੇ ਸਿਓਨ ਵਿੱਚ ਵੀ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਅਤੇ ਪਹਿਲੀ ਸਿਲਾ ਸਿਲਾਈ ਤਾਂ ਬੜੇ ਸੌਖੇ ਤਰੀਕੇ ਨਾਲ ਕੀਤੀ ਜਾਂਦੀ ਸੀ